ਹਾਂਜੀ ਸਾਡੇ ਇਲਾਕੇ ਦੇ ਲੋਕ ਘੁੰਮਣਾ ਫਿਰਨਾ ਆਦਿ ਬਹੁਤ ਪਸੰਦ ਕਰਦੇ ਹਨ ਜਿੱਦਾਂ ਕਿ ਟੂਰੈਸਟ 'ਤੇ ਘੁੰਮਣਾ ਫਿਰਨ ਜਾਣਾ ਬਾਹਰਲੇ ਦੇਸ਼ਾਂ 'ਚ ਘੁੰਮਣਾ ਫਿਰਨਾ ਮੌਸਮੀ ਧ ਅਧਾਰ 'ਤੇ ਘੁੰਮਣਾ ਫਿਰਨਾ ਧਾਰਮਿਕ ਧਾਰਮਿਕ ਸਥਾਨਾਂ 'ਤੇ ਘੁੰਮਣਾ ਫਿਰਨਾ ਆਦਿ ਕਾਫੀ ਪਸੰਦ ਕਰਦੇ ਹਨ ਜਿੱਦਾਂ ਕਿ ਮੌਸਮ ਦੇ ਅਧਾਰ 'ਤੇ ਹਿਮਾਚਲ ਵੱਲ ਨੂੰ ਘੁੰਮਣਾ ਫਿਰਨਾ ਸ਼ਿਮਲੇ ਹੋਇਆ ਠੰਡੀ ਇਲਾਕਾ 'ਚ ਘੁੰਮਣਾ ਫਿਰਨਾ ਸ਼੍ਰੀਨਗਰ ਵੱਲ ਨੂੰ ਘੁੰਮਣਾ ਫਿਰਨਾ ਮਨਾਲੀ ਵੱਲ ਨੂੰ ਘੁੰਮਣਾ ਫਿਰਨਾ ਆਦਿ ਅਤੇ ਧਾਰਮਿਕ ਅਧਾਰ 'ਤੇ ਜਿੱਦਾਂ ਕਿ ਆਪਣੀ ਸਿੱਖੀ ਲੋਕ ਜਿੱਦਾਂ ਗੁਰਦੁਆਰਾ ਗੁਰਦੁਆਰੇ ਆਦਿ 'ਤੇ ਘੁੰਮਦੇ ਫਿਰਦੇ ਹਨ ਜਿੱਦਾਂ ਕਿ ਫਤਿਹਗੜ੍ਹ ਸਾਹਿਬ ਹੋਇਆ ਅਨੰਦਪੁਰ ਸਾਹਿਬ ਹੋਇਆ ਇੱਦਾਂ ਹੀ ਆਦਿ ਯਾਤਰਾ ਘੁੰਮਣਾ ਫਿਰਨਾ ਪਸੰਦ ਕਰਦੇ ਹਨ ਅਤੇ ਆਪਣੇ ਹਿੰਦੂ ਹਿੰਦੂ ਲੋਕ ਕਈ ਮੰਦਰਾਂ 'ਚ ਘੁੰਮਣਾ ਫਿਰਨਾ ਪਸੰਦ ਕਰਦੇ ਹਨ ਜਿੱਦਾਂ ਕਿ ਕਾਲੀ ਮਾਤਾ ਦਾ ਮੰਦਰ ਹੋਰ ਆਦਿ ਮੰਦਰਾਂ ਚ ਘੁੰਮਣਾ ਫਿਰਨਾ ਬਹੁਤ ਪਸੰਦ ਕਰਦੇ ਹਨ ਅਤੇ ਬਾਹਰਲੇ ਦੇਸ਼ਾਂ ਕੋ ਕਿੰਨਾ ਕੁ ਜਿਨ੍ਹਾਂ ਕੋਲ ਜ਼ਿਆਦਾ ਬਜ਼ਟ ਹੁੰਦਾ ਹੈ ਹੈ ਉਹ ਆਪਣਾ ਬਾਹਰਲੇ ਦੇਸ਼ਾਂ 'ਚ ਸਫਰ ਕਰਦੇ ਹਨ ਘੁੰਮਦੇ ਫਿਰਦੇ ਹਨ ਅਤੇ ਟੂਰਿਸਟ 'ਤੇ ਜਾਂਦੇ ਹਨ ਜਿੱਦਾਂ ਡਵੱਈ ਹੋਇਆ ਯੂ ਐੱਸ ਏ ਅਮੈਰੀਕਾ ਬਜ਼ਟ ਦੇ ਹਿਸਾਬ ਨਾਲ ਅਗਲੇ ਬੰਦੇ ਘੁੰਮਦੇ ਫਿਰਦੇ ਹਨ ਅਤੇ ਅਸੀਂ